ਹਰ ਦੇਸ਼ ਅਤੇ ਪ੍ਰਾਂਤ ਦੇ ਲੋਕਾਂ ਦੀ ਭਾਸ਼ਾ ਵੱਖਰੀ ਵੱਖਰੀ ਹੁੰਦੀ ਹੈ ਸਮੁੱਚੇ ਵਿਸ਼ਵ ਵਿੱਚ ਭਾਸ਼ਾਵਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਆਮ ਤੌਰ 'ਤੇ ਦੇਸ਼ ਜਾਂ ਪ੍ਰਾਂਤ ਦੇ ਨਾਂ 'ਤੇ ਉੱਥੇ ਵਰਤੀ ਜਾਣ ਵਾਲੀ ਭਾਸ਼ਾ ਦਾ ਨਾਂ ਰੱਖਿਆ ਜਾਂਦਾ ਹੈ ਜਿਵੇਂ ਜਰਮਨੀ ਵਿੱਚ ਜਰਮਨ ਫਰਾਂਸ ਵਿੱਚ ਫਰੈਂਚ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਪੰਜਾਬ 'ਚ ਵਧੇਰੇ ਵਰਤੀ ਜਾਣ ਵਾਲੀ ਭਾਸ਼ਾ ਦਾ ਨਾਂ ਪੰਜਾਬੀ ਅਤੇ ਗੁਜਰਾਤ 'ਚ ਵਰਤੇ ਜਾਣ ਵਾਲੀ ਭਾਸ਼ਾ ਦਾ ਨਾਂ ਗੁਜਰਾਤੀ ਹੈ ਭਾਸ਼ਾ ਦੀ ਵਰਤੋਂ ਦੇ ਪੱਖ ਤੋਂ ਕਈ ਰੂਪ ਹੁੰਦੇ ਨੇ ਜਿਵੇਂ ਮਾਂ ਬੋਲੀ ਹੈ ਕੌਮੀ ਭਾਸ਼ਾ ਰਾਸ਼ਟਰੀ ਭਾਸ਼ਾ ਟਕਸਾਲੀ ਭਾਸ਼ਾ ਰਾਜ ਭਾਸ਼ਾ ਜਿਹੜੀ ਭਾਸ਼ਾ ਬੱਚਾ ਆਪਣੇ ਮਾਂ ਪਿਓ ਤੋਂ ਆਪਣੇ ਘਰ ਪਰਿਵਾਰ ਦੇ ਆਲੇ ਦੁਆਲੇ ਸਿੱਖਦਾ ਉਹ ਮਾਤ ਭਾਸ਼ਾ ਅਖਵਾਉਂਦੀ ਹੈ ਜਿਹੜੀ ਕਿਸੇ ਪ੍ਰਾਂਤ ਵਿਸ਼ੇਸ਼ ਤੇ ਭਾਸ਼ਾ ਨੂੰ ਰਾਜ ਭਾਸ਼ਾ ਦਾ ਦਰਜਾ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਹਰ ਦੇਸ਼ ਦੀ ਆਪਣੀ ਇੱਕ ਰਾਸ਼ਟਰੀ ਭਾਸ਼ਾ ਹੁੰਦੀ ਹੈ ਇਹ ਭਾਸ਼ਾ ਹੀ ਸਾਰੇ ਦੇਸ਼ ਵਾਸੀਆਂ ਨੂੰ ਇੱਕ ਦੂਜੇ ਨਾਲ ਜੋੜ ਕੇ ਰੱਖਦੀ ਹੈ ਜਿਹੜੀ ਭਾਸ਼ਾ ਵੱਖ ਵੱਖ ਦੇਸ਼ ਦੇ ਲੋਕਾਂ ਨੂੰ ਆਪਸ 'ਚ ਜੋੜਨ ਦਾ ਕੰਮ ਕਰਦੀ ਏ ਉਹਨੂੰ ਅੰਤਰਰਾਸ਼ਟਰੀ ਭਾਸ਼ਾ ਕਿਹਾ ਜਾਂਦਾ ਜਿਵੇਂ ਕਿ ਅੱਜ ਦੇ ਟਾਈਮ 'ਚ ਅੰਗਰੇਜ਼ੀ ਅੰਤਰਰਾਸ਼ਟਰੀ ਭਾਸ਼ਾ ਬਣ ਗਈ ਹੈ ਟਕਸਾਲੀ ਭਾਸ਼ਾ ਏ ਟਕਸਾਲੀ ਭਾਸ਼ਾ ਅਸੀਂ ਕਿਸੇ ਭਾਸ਼ਾ ਦੇ ਉਸ ਰੂਪ ਨੂੰ ਕਹਿੰਦੇ ਹਾਂ ਜਿਹਦੀ ਵਰਤੋਂ ਸਰਕਾਰੀ ਦਫਤਰਾਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਰੇਡੀਓ ਅਖਬਾਰਾਂ ਟੀ ਵੀ ਆਦਿ 'ਚ ਕੀਤੀ ਜਾਂਦੀ ਹੈ ਪੰਜਾਬੀ ਦੀ ਟਕਸਾਲੀ ਭਾਸ਼ਾ ਮਾਝੀ ਨੂੰ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਇੱਕ ਸਾਹਿਤਕ ਭਾਸ਼ਾ ਏ ਸਾਹਿਤਕ ਭਾਸ਼ਾ ਵਿੱਚ ਲਿਖਤੀ ਭਾਸ਼ਾ ਅਤੇ ਆਮ ਬੋਲ ਚਾਲ ਦੀ ਸ਼ਬਦਾਵਲੀ ਅਤੇ ਦੋਵਾਂ ਰੂਪਾਂ ਦੀ ਵਰਤੋਂ ਕੀਤੀ ਜਾਂਦੀ ਹੈ ਸਾਹਿਤਕ ਭਾਸ਼ਾ ਵਿੱਚ ਭਾਸ਼ਾ ਦੇ ਟਕਸਾਲੀ ਰੂਪ ਦੀ ਵਧੇਰੇ ਵਰਤੋਂ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਜਦੋਂ ਇਲਾਕੇ ਵਿਸ਼ੇਸ਼ ਦੇ ਸਾਹਿਤਕਾਰ ਕਿਸੇ ਉਪ ਭਾਸ਼ਾ ਦੀ ਵਧੇਰੇ ਵਰਤੋਂ ਕਰਦੇ ਹਨ ਤਾਂ ਉਹ ਅਜਿਹੀਆਂ ਰਚਨਾਵਾਂ ਨੂੰ ਆਂਚਲੀ ਕੰਗਣ ਵਾਲੀਆਂ ਰਚਨਾਵਾਂ ਆਖਿਆ ਜਾਂਦਾ ਹੈ ਪੰਜਾਬੀ ਸਾਹਿਤ ਵਿੱਚ ਰਾਮ ਸਰੂਪ ਅੰਖੀ ਦੀਆਂ ਰਚਨਾਵਾਂ ਜਿਹੜੀਆਂ ਉਹ ਮਲਵਈ ਉਪ ਭਾਸ਼ਾ ਦੀ ਵਰਤੋਂ ਨਾਲ ਚਲਦੀਆਂ ਹਨ